ਹੈਲੋ ਸਤਿ ਸ਼੍ਰੀ ਅਕਾਲ ਜੀ ਆਪਣਾ ਦਸ਼ਮੇਸ਼ ਟ੍ਰੈਵਲ ਤੋਂ ਬੋਲਦੇ ਓਂ ਤਿੰਨਕੋਣੇ ਬਠਿੰਡਾ ਠੀਕ ਹੈ ਜੀ ਸਰ ਐਕਚੁਲੀ ਗੱਲ ਇਹ ਹੈ ਕਿ ਅਸੀਂ ਪੰਜ ਸੱਤ ਦੋਸਤਾਂ ਨੇ ਇੱਕ ਪ੍ਰੋਗਰਾਮ ਬਣਾਇਆ ਹੈ ਅਸੀਂ ਜਾਣਾ ਹੈ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਹਾਂਜੀ ਉੱਤਰਾਖੰਡ ਅਤੇ ਜਨਾਬ ਤੁਹਾਡੇ ਤੋਂ ਗੱਡੀ ਦੀ ਬੇਨਤੀ ਹੈ ਜੀ ਗੱਡੀ ਚਾਹੀਦੀ ਇਨੋਵਾ ਗੱਡੀ ਹਾਂਜੀ ਮਿਲਜੂ ਜੀ ਹਾਂ ਨਹੀਂ ਦੂਜੀ ਗੱਡੀ ਨੀ ਚਾਹੀਦੀ ਦੂਜੀ ਦਾ ਇਹ ਹੈ ਨਾ ਸਫ਼ਰ ਹੈ ਲੰਬਾ ਅਤੇ ਇਹਦੀਆਂ ਸੀਟਾਂ ਥੋੜ੍ਹੀਆਂ ਜਿਹੀਆਂ ਹੁੰਦੀਆਂ ਹੈ ਸਹੀ ਤੁਹਾਨੂੰ ਪਤਾ ਹੈ ਬੈਠਣ 'ਚ ਦਿੱਕਤ ਨਹੀਂ ਆਉਂਦੀ ਠੀਕ ਹੈ ਨਾ ਅਤੇ ਇਨੋਵਾ ਹੀ ਚਾਹੀਦੀ ਹੈ ਹਾਂਜੀ ਅਤੇ ਹਾਂਜੀ ਬਿਲਕੁਲ ਅਤੇ ਹੋਜੂਗਾ ਇੰਤਜ਼ਾਮ ਠੀਕ ਹੈ ਜੀ ਅਤੇ ਜਨਾਬ ਤੁਹਾਡੇ ਰੇਟ ਵਗੈਰਾ ਕੁਛ ਪਤਾ ਲੱਗ ਜਾਣਗੇ ਕਿਵੇਂ ਤੁਸੀਂ ਦਿਹਾੜੀ ਦੇ ਹਿਸਾਬ ਹਿਸਾਬ ਨਾਲ ਲੈਂਦੇ ਹੋ ਕਿ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚਾਰਜ ਕਰਦੇ ਹਾਂ ਕਿਉਂਕਿ ਸਾਰੇ ਪ੍ਰਤੀ ਕਿਲੋਮੀਟਰ ਦੇ ਨਾਲ ਹੀ ਕਰਦੇ ਹੈ ਠੀਕ ਹੈ ਜੀ ਅਤੇ ਕਿੰਨੇ ਰੁਪਏ ਚਾਰਜ ਕਰੋਗੇ ਤੁਸੀਂ ਅੱਠ ਰੁਪਏ ਪ੍ਰਤੀ ਕਿਲੋਮੀਟਰ ਹੈਂਅ ਓਕੇ ਕੋਈ ਰੈਤ ਕੋਈ ਨਹੀਂ ਹਾਂ ਜੀ ਉਹ ਤਾਂ ਮੈਂ ਪਤਾ ਕੀਤਾ ਮਾਰਕੀਟ ਦੇ ਵਿੱਚ ਵੀ ਅੱਠ ਤੋਂ ਘੱਟ ਤਾਂ ਕੋਈ ਕਰਦਾ ਹੀ ਨਹੀਂ ਚਲੋ ਬਸ ਡ੍ਰਾਈਵਰ ਸਾਨੂੰ ਚਾਹੀਦਾ ਜਿਹੜਾ ਸੋਫ਼ੀ ਹੋਵੇ ਦਾਰੂ ਦੁਰੂ ਨਾ ਪੀਂਦਾ ਹੋਵੇ ਇਹ ਤੁਸੀਂ ਧਿਆਨ ਰੱਖਿਓ ਪਲੀਜ ਠੀਕ ਹੈ ਨਾ ਹਾਂਜੀ ਜਾਵਾਂਗੇ ਮਤਲਬ ਹੁਣ ਕਿੰਨੀ ਅੱਜ ਕਿੰਨੀ ਹੋ ਗਈ ਉਨੱਤੀ ਮਈ ਹੋ ਗਈ ਨਾ ਆਪਾਂ ਜਾਵਾਂਗੇ ਜੀ ਪੰਜ ਜੂਨ ਨੂੰ ਠੀਕ ਹੈ ਅਤੇ ਪੰਜ ਤੋਂ ਲੈ ਕੇ ਲਗਭਗ ਹਫ਼ਤੇ ਤੋਂ ਲੈ ਕੇ ਦਸ ਦਿਨ ਦਾ ਟੂਰ ਹੈ ਕਿਉਂਕਿ ਦੇਹਰਾਦੂਨ ਹੁੰਦੇ ਜਾਣਾ ਆਪਾਂ ਅਤੇ ਆਉਂਦੇ ਹੋਏ ਆਪਾਂ ਮੰਸੂਰੀ ਵੀ ਦੇਖ ਲਵਾਂਗੇ ਹਰਿਦੁਆਰ ਅਤੇ ਰਿਸ਼ੀਕੇਸ਼ ਦੇ ਵੀ ਦਰਸ਼ਨ ਕਰਲਾਂਗੇ ਪਹਿਲਾਂ ਲੇਕਿਨ ਸਿੱਧਾ ਹੇਮਕੁੰਟ ਸਾਹਿਬ ਜਾਵਾਂਗੇ ਆਪਾਂ ਠੀਕ ਹੈ ਜੀ ਤਾਂ ਠੀਕ ਹੈ ਜੀ ਮੈਂ ਫਿਰ ਤੁਹਾਡੇ ਨਾਲ ਮਿਲਦਾ ਐ ਆਪਾਂ ਫਾਈਨਲ ਕਰ ਲੈਂਦੇ ਹਾਂ ਤੁਹਾਡੇ ਔਫਿਸ ਆਉਣਾ ਮੈਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ